ਸਤਿ ਸ਼੍ਰੀ ਅਕਾਲ ਜੀ ਪੂਜਾ ਜਨਰਲ ਸਟੋਰ ਤੋਂ ਗੱਲ ਕਰ ਰਹੇ ਹੋ ਮੈਂ ਤੁਹਾਡੀ ਕੰਪਨੀ ਤੋਂ ਤੇਲ ਔਰਡਰ ਕੀਤਾ ਸੀ ਅਤੇ ਔਰਡਰ ਦਿੰਦੇ ਸਮੇਂ ਤੁਸੀਂ ਮੈਨੂੰ ਚਾਰ ਦਿਨ ਦਾ ਟਾਈਮ ਦਿੱਤਾ ਸੀ ਪਰ ਹੁਣ ਤਾਂ ਦਸ ਦਿਨ ਹੋ ਚੁੱਕੇ ਨੇ ਮੇਰਾ ਔਰਡਰ ਦਿੱਤੇ ਨੂੰ ਮੈਂ ਤਾਂ ਪੈਸੇ ਵੀ ਤੁਹਾਨੂੰ ਪਹਿਲਾਂ ਦੇ ਚੁੱਕੀ ਹਾਂ ਇਹ ਤੇਲ ਮੈਂ ਅੱਗੇ ਆਪਣੀ ਸਹੇਲੀ ਨੂੰ ਦੇਣਾ ਸੀ ਜਿਸ ਨੇ ਪਰਸੋਂ ਨੂੰ ਇੱਥੋਂ ਮੇਰੇ ਕੋਲੋਂ ਚਲੇ ਜਾਣਾ ਜਾਂ ਤਾਂ ਤੁਸੀਂ ਮੇਰਾ ਪੈਸੇ ਵਾਪਸ ਕਰ ਦਿਓ ਜਾਂ ਕੱਲ ਤੱਕ ਮੇਰਾ ਔਰਡਰ ਮੈਨੂੰ ਮੇਰੇ ਪਤੇ 'ਤੇ ਪਹੁੰਚਾ ਦਿਓ